ਮੇਰੇ ਹਿਸਾਬ ਨਾਲ ਯੋਗਾ ਸ਼ੁਰੂ ਕਰਨ ਦੀ ਕੋਈ ਸਹੀ ਉਮਰ ਨਹੀਂ ਹੈਗੀ ਪਰ ਜੇ ਸ ਛੋਟੀ ਉਮਰ ਵਿੱਚ ਜੇ ਸ਼ੁਰੂ ਕੀਤਾ ਜਾਵੇ ਤਾਂ ਇਸਦਾ ਕੋਈ ਨੁਕਸਾਨ ਨਹੀਂ ਇਸਦੇ ਫਾਈਦੇ ਹੀ ਫਾਈਦੇ ਹਨ ਕਿਉਂਕਿ ਜੇ ਆਪਾਂ ਯੋਗ ਛੋਟੀ ਉਮਰ ਵਿੱਚ ਸ਼ੁਰੂ ਕਰਦੇ ਹਾਂ ਤਾਂ ਇਸ ਨਾਲ ਸਾਡਾ ਸਰੀਰ ਉਸ ਹਿਸਾਬ ਨਾਲ ਢਲ ਜਾਂਦਾ ਹੈ ਅਤੇ ਜੇ ਇਸ ਨਾਲ ਆਪਣੀ ਉਮ ਸਰੀਰ ਸਹੀ ਤਰ੍ਹਾਂ ਵਿਕਸਿਤ ਹੁੰਦਾ ਹੈ ਅਤੇ ਇਸ ਨਾਲ ਆਪਣਾ ਪੁਰਾਣਾ ਜਾਂ ਵਗੈਰਾ ਆਸਨ ਕਰਨ ਵਿੱਚ ਸਾਨੂੰ ਬੜਤੀ ਉਮਰ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਅਤੇ ਸਾਡਾ ਸਰੀਰ ਹਮੇਸ਼ਾ ਲਈ ਫਿਟ ਰਹਿੰਦਾ ਹੈ